ਹੈਲੋ ਹਾਂਜੀ ਤੁਸੀਂ ਉਬਰ ਤੋਂ ਬੋਲਦੇ ਹੋ ਸਰ ਮੈਂ ਕੱਲ੍ਹ ਨਾ ਪਟਿਆਲਾ ਤੋਂ ਚੰਡੀਗੜ੍ਹ ਜਾਣ ਲਈ ਤੁਹਾਡੀ ਕੈਬ ਬੁੱਕ ਕੀਤੀ ਸੀ ਜਿਹਦੇ ਵਿੱਚ ਮੇਰੇ ਨਾਲ ਤੁਹਾਡੀ ਇੱਕ ਹਜ਼ਾਰ ਰੁਪਏ ਦੇ ਵਿੱਚ ਗੱਲ ਹੋਈ ਸੀਗੀ ਪਰ ਜਿਵੇਂ ਮੈਂ ਚੰਡੀਗੜ੍ਹ ਜਾ ਕੇ ਉੱਤਰੀ ਤਾਂ ਤੁਹਾਡੇ ਡਰਾਈਵਰ ਨੇ ਮੇਰੇ ਤੋਂ ਪੰਦਰਾਂ ਸੌ ਰੁਪਏ ਮੰਗੇ ਮੈਂ ਉਹਨੂੰ ਕਿਹਾ ਮੇਰੀ ਇੱਕ ਹਜ਼ਾਰ ਰੁਪਏ ਦੇ ਵਿੱਚ ਗੱਲ ਹੋਈ ਆ ਅਤੇ ਮੈਂ ਉਹਨੂੰ ਇੱਕ ਹਜ਼ਾਰ ਦਾ ਹੀ ਭੁਗਤਾਨ ਕੀਤਾ ਪਰ ਡਰਾਈਵਰ ਨੇ ਬਹੁਤ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਉਸ ਦੀ ਡਰਾਈਵਿੰਗ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਸੀਗੀ ਸਰ ਅੱਗੇ ਤੋਂ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਵੀ ਕੋਈ ਵੀ ਡਰਾਈਵਰ ਕਿਸੇ ਵੀ ਸਵਾਰੀ ਨਾਲ ਇੱਦਾਂ ਦਾ ਬਿਹੇਵੀਅਰ ਨਾ ਕਰੇ ਮੈਂ ਕਾਫ਼ੀ ਟਾਈਮ ਤੋਂ ਤੁਹਾਡੀ ਸਰਵਿਸ ਲੈ ਰਹੀ ਹਾਂ ਗੀ ਮੇਰੇ ਨਾਲ ਕਦੇ ਵੀ ਇੱਦਾਂ ਨਹੀਂ ਹੋਇਆ ਕਰੀਬ ਦੋ ਸਾਲ ਤੋਂ ਮੈਂ ਉਬਰ ਬੁੱਕ ਕਰ ਰਹੀ ਹਾਂ ਅਤੇ ਆਪਣੇ ਸਫਰ ਦੇ ਲਈ ਮੇਰਾ ਐਕਸਪੀਰੀਅੰਸ ਚੰਗਾ ਰਿਹਾ ਉਸ ਟਾਈਮ ਪਰ ਮੇਰੇ ਨਾਲ ਕੱਲ੍ਹ ਇੱਦਾਂ ਹੋਇਆ ਅੱਗੇ ਤੋਂ ਤੁਸੀਂ ਆਪਣੇ ਡਰਾਈਵਰ ਨੂੰ ਇੱਦਾਂ ਦੀਆਂ ਇੰਸਟ੍ਰਕਸ਼ਨ ਦੇਣੀਆਂ ਕਿ ਉਹ ਕਿਸੇ ਵੀ ਸਵਾਰੀ ਦੇ ਨਾਲ ਇੱਦਾਂ ਦਾ ਬਿਹੇਵੀਅਰ ਨਾ ਕਰਨ ਧੰਨਵਾਦ ਜੀ